ਨਮਸਤੇ ਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਹਾਂ ਹਾਂਜੀ ਹਾਂਜੀ ਮੈਮ ਦੱਸੋ ਹਾਂਜੀ ਕਿਉਂ ਮੈਮ ਓਕੇ ਜੀ ਓਕੇ ਠੀਕ ਹੈ ਹਾਂਜੀ ਮੈਮ ਅੱਛਾ ਮੈਮ ਓਕੇ ਜੀ ਹਾਂਜੀ ਮੈਮ ਬੱਚਾ ਵਧੀਆ ਘਰ ਤਾਂ ਬਹੁਤ ਆ ਕੇ ਖੁਸ਼ ਹੁੰਦੀ ਆ ਹਾਂਜੀ ਹਾਂਜੀ ਕਰਦੇ ਨੇ ਅਤੇ ਕਹਿੰਦੇ ਨੇ ਵੀ ਹਾਂ ਸਾਨੂੰ ਟੀਚਰ ਨੇ ਇਹ ਕਰਵਾਇਆ ਉਹ ਕਰਵਾਇਆ ਮਤਲਬ ਵੈਸੇ ਤਾਂ ਘਰੋਂ ਤਾਂ ਵਧੀਆ ਹਾਂਜੀ ਮੈਮ ਉਹ ਨਾ ਹਾਂਜੀ ਉਹ ਸਪੋਰਟਸ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਘੱਟ ਰਹੀ ਆ ਬਟ ਮੈਥ ਦੇ ਵਿੱਚ ਥੋੜ੍ਹਾ ਪਹਿਲਾਂ ਹੈਗੀ ਸੀ ਹੁਣ ਥੋੜ੍ਹਾ ਜਿਹਾ ਹੋ ਗਿਆ ਕੋਈ ਨਾ ਉਹਦੇ ਵੱਲ ਜ਼ਿਆਦਾ ਧਿਆਨ ਦੇਵਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਹਾਂਜੀ ਮੈਮ ਬਾਕੀ ਸਬਜੈਕਟਾਂ 'ਚ ਬੱਚਾ ਕਿਵੇਂ ਆ ਖੁਸ਼ਨੂਰ ਹਾਂਜੀ ਹਾਂ ਨਹੀਂ ਨਹੀਂ ਮੈਮ ਧਿਆਨ ਤਾਂ ਦਿੰਦੇ ਹਾਂਜੀ ਥੋੜ੍ਹਾ ਜਿਹਾ ਘਰ ਦੇ ਇਸ਼ੂਜ ਕਰਕੇ ਥੋੜ੍ਹਾ ਹੋ ਜਾਂਦਾ ਬਟ ਕੋਈ ਨਹੀਂ ਅੱਗੇ ਤੋਂ ਧਿਆਨ ਰੱਖਾਂਗੇ ਹਾਂਜੀ ਹਾਂਜੀ ਹੈਗੇ ਨੇ ਉਹ ਵੀ ਨਾਲੇ ਨੇ ਹਾਂਜੀ ਹਾਂਜੀ ਅੱਛਾ ਜੀ ਚਲੋ ਕੋਈ ਨਾ ਉਹਦੇ ਹਾਂਜੀ ਹਾਂਜੀ ਜ਼ਰੂਰ ਉਹ ਉਹਨਾਂ ਦਾ ਕੀ ਕਿਹੜੇ ਸਬਜੈਕਟ ਵਿੱਚ ਜ਼ਿਆਦਾ ਵੀਕ ਨੇ ਫਿਰ ਉਹਦੇ ਵੱਲ ਜ਼ਿਆਦਾ ਧਿਆਨ ਦਈਏ ਨਾ ਜੀ ਓਕੇ ਹਾਂਜੀ ਹਾਂਜੀ ਉਹ ਹਾਂਜੀ ਮੈਮ ਉਹ ਨਾ ਥੋੜ੍ਹਾ ਜਿਹਾ ਚਿਰ ਪਹਿਲਾਂ ਨਾ ਬਿਮਾਰ ਜੇ ਹੋ ਗਏ ਸੀ ਉਹਦੇ ਕਰਕੇ ਜ਼ਿਆਦਾ ਹੋ ਗਏ ਨਹੀਂ ਤਾਂ ਪਹਿਲਾਂ ਤਾਂ ਸਹੀ ਸੀਗੀ ਉਹ ਕੋਈ ਨਹੀਂ ਬਾਕੀ ਅਸੀਂ ਧਿਆਨ ਦੇਵਾਂਗੇ ਠੀਕ ਹੈ ਠੀਕ ਹੈ ਜੀ ਠੀਕ ਆ ਓਕੇ ਮੈਮ ਥੈਂਕ ਯੂ